ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਵੀ ਸਰ ਮੈਂ ਪੰਜਾਬ ਵਿੱਚ ਨਵੀਆਂ ਟੈਕਨੋਲਜੀਆਂ ਦੇ ਖੇਤਰ ਵਿੱਚ ਦੂਜੇ ਰਾਜਾਂ ਦੇ ਖੇਤਰਾਂ ਨਾਲੋਂ ਆਪਣਾ ਪੰਜਾਬ ਵੀ ਪਿੱਛੇ ਕਿਉਂ ਆ ਪਹਿਲਾਂ ਵਾਲੇ ਸਮੇਂ ਵਿੱਚ ਵੀ ਜਦੋਂ ਖੇਤੀਬਾੜੀ ਕੀਤੀ ਜਾਂਦੀ ਸੀਗੀ ਉਸ ਟੈਮ ਕਣਕ ਵਗੈਰਾ ਹੱਥੀਂ ਵੱਡੀ ਜਾਂਦੀ ਹੁੰਦੀ ਸੀ ਬੀਜਣ ਵੇਲੇ ਵੀ ਘੱਟ ਪਟਰੋਲ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਉਦੋਂ ਤਾਂ ਵੀ ਜਦੋਂ ਵੀ ਕੋਈ ਖੇਤੀਬਾੜੀ ਦਾ ਕੋਈ ਸੰਦ ਲਿਆ ਜਾਂਦਾ ਸੀ ਇੱਕ ਦੂਜੇ ਨਾਲ ਉਧਾਰ ਸੁਧਾਰ ਕਰ ਲੈਂਦੇ ਸੀਗੇ ਉਦੋਂ ਹਲ ਵਾਹੁਣ ਵੇਲੇ ਅਤੇ ਆਪਣੇ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀਗੀ ਅਤੇ ਹੋਰ ਵੀ ਕੋਈ ਚੀਜ਼ ਫਸਲਾਂ ਉਗਾਉਣ ਵੇਲੇ ਐਨੇ ਰਿਆਂ ਸਪਰਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਉਦੋਂ ਨੈਚੁਰ ਨੋਰਮਲ ਖਾਦ ਰੂੜੀ ਦੀ ਖਾਦ ਪਾ ਕੇ ਹੀ ਉਹ ਕੀਤਾ ਜਾਂਦਾ ਉਹਦਾ ਜੀ ਫਸਲ ਨੂੰ ਤਿਆਰ ਕੀਤਾ ਜਾਂਦਾ ਸੀਗਾ ਪਹਿਲਾਂ ਵਾਲੇ ਸਮੇਂ ਦੇ ਅਤੇ ਅੱਜ ਦੇ ਸਮੇਂ ਵਿੱਚ ਵੀ ਬਹੁਤ ਹੀ ਜ਼ਿਆਦਾ ਫਰਕ ਆ ਉਦੋਂ ਵੀ ਇੱਕ ਫਸਲ ਦੇ ਨਾਲ ਦੋ ਦੋ ਫਸਲਾਂ ਉਗਾਈਆਂ ਜਾਂਦੀਆਂ ਸੀਗੀਆਂ ਪਰ ਜੇ ਆਪਾਂ ਪਹਿਲੇ ਵਾਲੇ ਸਮੇਂ ਪਹਿਲਾਂ ਚਲੋ ਖੇਤੀਬਾੜੀ ਕੀਤੀ ਜਾਂਦੀ ਸੀ ਉਦੋਂ ਬਿਨਾਂ ਰੇਹਾਂ ਸਪਰਿਹਾਂ ਤੋਂ ਕੀਤੀ ਜਾਂਦੀ ਸੀਗੀ ਕਣਕ ਵਧੀਆ ਤਰੀਕੇ ਦੀ ਫਸਲ ਦਾ ਝਾੜ ਆਉਂਦਾ ਸੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਪਰ ਜੇ ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਜਦੋਂ ਵੀ ਆਪਾਂ ਕਣਕ ਵਗੈਰਾ ਲਾਉਂਦੇ ਹਾਂ ਗਰੂਰ ਨੂੰ ਪਹਿਲਾਂ ਵਾਹਣ ਨੂੰ ਵਾਹੁਣਾ ਪੈਂਦਾ ਫਿਰ ਬੀਜਣ ਵਾਸਤੇ ਅਲੱਗ ਟਰੈਕਟਰ ਦੀ ਜ਼ਰੂਰਤ ਪੈਂਦੀ ਹੈਗੀ ਫਿਰ ਉਹਨੂੰ ਆਪਾਂ ਫਸਲ ਨੂੰ ਕੱਟਦੇ ਔਰ ਪਹਿਲਾਂ ਵਾਲੇ ਸਮੇਂ ਵਿੱਚ ਤਾਂ ਕੰਬਾਈਨਾਂ ਵਗੈਰਾ ਨਹੀਂ ਹੁੰਦੀਆਂ ਸੀ ਪਰ ਅੱਜ ਦੇ ਟਾਈਮ ਵਿੱਚ ਕੰਬਾਈਨਾਂ ਦੀ ਵਰਤੋਂ ਵਰਤੋਂ ਆ ਗਈ ਕੋਈ ਫਸਲ ਨੂੰ ਕੱਟਣ ਵੇਲੇ ਜ਼ਿਆਦਾ ਤੇਲ ਪਟਰੋਲ ਵੀ ਦੀ ਵਰਤੋਂ ਕੀਤੀ ਜਾਂਦੀ ਹੈਗੀ ਜ਼ਿਆਦਾਤਰ ਹੁਣ ਝੋਨਾ ਹੀ ਜ਼ਿਆਦਾ ਲਗਾਇਆ ਜਾਂਦਾ ਕੋਈ ਵੀ ਨਰਮਾ ਵਗੈਰਾ ਤਾਂ ਲਗਾਉਣੋਂ ਹੱਟ ਹੀ ਗਿਆ ਕਿਉਂਕਿ ਪੀਸ ਪਹਿਲਾਂ ਵਾਲੇ ਟਾਈਮ ਵਿੱਚ ਪਾਣੀ ਦੀ ਘੱਟ ਜ਼ਰੂਰਤ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਦੇ ਟਾਈਮ ਵਿੱਚ ਪਾਣੀ ਦੀ ਵੀ ਵਰਤੋਂ ਬਹੁਤ ਜ਼ਿਆਦਾ ਝੋਨੇ ਦੇ ਕਰਕੇ ਪਾਣੀ ਵੀ ਨੀਚੇ ਤੱਕ ਜਾ ਰਿਹਾ ਸਰ ਹਾਂਜੀ ਸਰ ਵੀ ਪਾਣੀ ਦਾ ਡੂੰਘਾਓ ਵੀ ਨੀਚੇ ਤੱਕ ਜਾ ਰਿਹਾ ਜਿਸ ਕਰਕੇ ਵੀ ਕੋਈ ਹੋਰ ਫਸਲ ਦਾ ਉਗਾਉਣਾ ਤਾਂ ਮੁਸ਼ਕਿਲ ਹੀ ਹੋਇਆ ਪਿਆ ਹੈਗਾ ਹਾਂਜੀ ਸਰ ਜਦੋਂ ਪਹਿਲਾਂ ਵੀ ਕੋਈ ਸਰ੍ਹੋਂ ਵਗੈਰਾ ਕੱਢੀ ਜਾਂਦੀ ਹੁੰਦੀ ਸੀ ਉਹ 'ਤੇ ਵੀ ਲੋਕ ਡਰੰਮਾਾਂ ਉੱਤੇ ਝਾੜ ਝਾੜ ਕੱਢਦੇ ਸੀ ਪਰ ਅੱਜ ਦੇ ਟਾਈਮ ਵਿੱਚ ਤਾਂ ਹਡੰਬੇ ਦੀ ਵਰਤੋਂ ਨਾਲ ਦਸ ਜੇ ਆਪਾਂ ਕਿੱਲੇ ਦੀ ਦੀ ਸਰ੍ਹੋਂ ਦਸ ਪੰਦਰਾਂ ਮਿੰਟ 'ਚ ਹੀ ਨਿਕਲ ਜਾਂਦੀ ਹੈਗੀ ਹਾਂਜੀ ਸਰ ਪਹਿਲਾਂ ਵਾਲੇ ਟਾਈਮ ਨਾਲ ਵੀ ਸਾਡੇ ਪੰਜਾਬ ਨੇ ਵੀ ਬਹੁਤ ਤਰੱਕੀ ਕੀਤੀ ਹੈਗੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਪਰ ਹੁਣ ਵਿੱਚ ਜੇ ਕੋਈ ਖੇਤ ਹੁਣ ਪਹਿਲਾਂ ਰੇਹਾਂ ਬਿਨਾਂ ਰੇਹਾਂ ਸਪਰਿਆਂ ਤੋਂ ਕਣਕ ਉਗਾਈ ਜਾਂਦੀ ਸੀ ਪਰ ਜੇ ਆਪਾਂ ਹੁਣ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਫਸਲ ਉਗਾਉਣ ਵਿੱਚ ਸਪਰੇ ਯੂਰੀਆ ਸਪਰੇ ਕੋਈ ਮਰਜ਼ੀ ਸਪਰੇ ਜਾਂ ਕੋਈ ਪਾਉਂਦੇ ਰੇਹ ਵਗੈਰਾ ਪਾਉਂਦੇ ਹੈਗੇ ਤਾਂ ਵੀ ਇੱਕ ਤਾਂ ਜਿਹੜੀ ਫਸਲ ਦਾ ਜਦੋਂ ਝਾੜ ਵੀ ਚੰਗਾ ਆਉਂਦਾ ਪਰ ਖਾਂਦੇ ਤਾਂ ਆਪਾਂ ਰੇਹਾਂ ਸਪਰੇਆਂ ਵਾਲੀ ਚੀਜ਼ ਹੀ ਹੈ ਨਾ ਹਾਂਜੀ ਸਰ ਹਾਂਜੀ ਹਾਂਜੀ ਪਰ ਜੇ ਹੁਣ ਆਪਾਂ ਵੀ ਕਿਸੇ ਹੋਰ ਭਾਰਤ ਨਾਲ ਆਪਣੇ ਦੇਸ਼ ਦਾ ਕੰਪੈਰੀਜ਼ਨ ਕਰੀਏ ਫਰਕ ਕਰੀਏ ਤਾਂ ਵੀ ਆਪਣੇ ਇੱਧਰਲੇ ਰੇਟ ਉੱਧਰਲੇ ਰੇਟ ਨਾਲੋਂ ਬਹੁਤ ਜ਼ਿਆਦਾ ਘੱਟ ਹੈਗੇ ਇੱਧਰੋਂ ਆਪਾਂ ਫਸਲ ਵੇਚ ਕੇ ਜਦੋਂ ਉੱਧਰ ਫਸਲ ਵੇਚਦੇ ਹਾਂ ਆਪਣਾ ਦਾਮ ਘੱਟ ਲੱਗਦਾ ਫਸਲ ਦਾ ਹਾਂਜੀ ਸਰ ਹਾਂਜੀ ਸਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਠੀਕ ਹੈ ਵੀ ਉੱਧਰ ਆਪਣਾ ਦਾਮ ਘੱਟ ਲੱਗਦਾ ਵੀ ਆਪਾਂ ਇੱਧਰੋਂ ਇੰਨੀ ਫਸਲ ਵੇਚ ਕੇ ਹਾਂਜੀ ਵੀ ਮੇਰੇ ਸਰਕਾਰ ਵੱਲੋਂ ਵੀ ਇਹ ਅਪੀਲ ਹੈ ਨਾ ਵੀ ਆਪਣੇ ਵੀ ਪੰਜਾਬ ਨੇ ਤਰੱਕੀ ਤਾਂ ਬਹੁਤ ਕੀਤੀ ਆ ਪਰ ਉਸ ਤਰ੍ਹਾਂ ਦੇ ਨਵੀਆਂ ਤਕਨੀਕਾਂ ਇੱਧਰ ਹੋਰ ਲਿਆਉਂਦੀਆਂ ਜਾਣ ਜਿਸ ਕਰਕੇ ਵੀ ਪੰਜਾਬ ਵੀ ਹੋਰ ਰਾਜਾਂ ਨਾਲੋਂ ਵੀ ਵਧੀਆ ਰਹਿ ਵੀ ਖੇਤੀ ਕਰ ਸਕੇ ਹਾਂਜੀ ਸਰ ਵੀ ਹੋਰ ਰਾਜਾਂ ਵਿੱਚ ਨਵੀਂਆਂ ਤੋਂ ਨਵੀਆਂ ਤਕਨੀਕਾਂ ਆ ਰਹੀਆਂ ਉਹ ਆਪ ਦੇ ਰੇਟ ਹਾਈ ਕਰ ਰਹੇ ਹੈ ਅਤੇ ਆਪਣੇ ਰੇਟ ਇੱਧਰੋਂ ਘਟਾਏ ਜਾ ਰਹੇ ਹੈਗੇ ਅਤੇ ਬਾਹਰ ਜਾ ਕੇ ਆਪਣੀ ਫਸਲ ਦੇ ਵੱਧ ਤੋਂ ਵੱਧ ਰੇਟਾਂ ਉੱਤੇ ਫਸਲ ਵੇਚੀ ਜਾਂਦੀ ਆ ਚੌਲ ਵਗੈਰਾ ਦਾਲਾਂ ਵਗੈਰਾ ਜਾਂਦਾ ਤਾਂ ਉਹ ਆਪਣੇ ਪੰਜਾਬ ਵਿੱਚੋਂ ਹੈ ਪਰ ਉਹ ਅੱਗੇ ਜਾ ਕੇ ਹੋਰ ਵੇਚਿਆ ਜਾਂਦਾ ਹਾਂਜੀ ਸਰ ਸਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਠੀਕ ਆ ਹਾਂਜੀ ਸਰ ਵੀ ਆਪਣੀ ਬਸ ਸਰਕਾਰ ਵੱਲ ਇਹ ਹੀ ਅਪੀਲ ਹੈ ਵੀ ਆਪਣੇ ਵੀ ਪੰਜਾਬ ਨੂੰ ਉਨੀਆਂ ਹੀ ਟੈਕਨੋਲਜੀਆਂ ਤਕਨੀਕਾਂ ਦਿੱਤੀਆਂ ਜਾਣ ਜਿੰਨੀਆਂ ਕਿ ਬਾਕੀ ਰਾਜਾਂ ਵਿੱਚ ਆ ਤਾਂ ਜੋ ਆਪਣਾ ਪੰਜਾਬ ਵੀ ਹੋਰ ਤਰੱਕੀ ਕਰ ਸਕੇ ਅਤੇ ਪੰਜਾਬ ਦੀ ਪੈਦਾਵਾਰ ਵੱਧ ਸਕੇ ਥੈਂਕ ਯੂ ਸੋ ਮੱਚ ਸਰ